ਫਿਲਮ ਕਲਾਕਾਰ ਬਾਰੇ ਕੋਈ ਵੀ ਚੀਜ਼ ਕੋਈ ਵੀ ਗੱਲ ਕਹੀ ਸੱਚ ਵੀ ਹੋ ਸਕਦੀ ਆ ਅਤੇ ਗਲਤ ਵੀ ਹੋ ਸਕਦੀ ਆ ਅਸਲ ਦੇ ਵਿੱਚ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਕਲਾਕਾਰਾਂ ਬਾਰੇ ਕਈ ਗਲਤ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ ਜਦ ਕਿ ਉਹਨਾਂ ਦੇ ਵਿੱਚ ਬਹੁਤ ਘੱਟ ਸੱਚ ਹੁੰਦੀਆਂ ਹਨ ਅਤੇ ਕਈ ਝੂਠ ਹੁੰਦੀਆਂ ਹਨ ਲੋਕਾਂ ਲੋਕ ਤਾਂ ਇਸ ਤਰ੍ਹਾਂ ਉਹਨਾਂ ਨੂੰ ਕਈ ਪ੍ਰਮੋਟ ਕਰਨ ਦੇ ਲਈ ਉਹਨਾਂ ਬਾਰੇ ਕੋਈ ਅਸਲ ਕਹਾਣੀ ਦੱਸ ਦਿੰਦੇ ਹੈ ਕੋਈ ਗਲਤ ਦੱਸ ਦਿੰਦੇ ਹੈ